ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ ਜੋ ਅਸੀਂ ਬਚਪਨ ਤੋਂ ਸਿੱਖਦੇ ਹਾਂ ਆਪਣੇ ਘਰ ਤੋਂ ਪਰਿਵਾਰ ਤੋਂ ਸਕੂਲ ਤੋਂ ਪਰ ਹੁਣ ਸਾਡੇ ਦੇਸ਼ ਵਿੱਚ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਇਹਨਾਂ ਭਾਸ਼ਾਵਾਂ ਨੇ ਸਾਡੀ ਮਾਂ ਬੋਲੀ ਭਾਸ਼ਾ ਨੂੰ ਦੱਬ ਕੇ ਰੱਖ ਦਿੱਤਾ ਹੈ ਸਕੂਲਾਂ ਕਾਲਜਾਂ ਦੇ ਵਿੱਚ ਵੀ ਹਿੰਦੀ ਬੋਲੀ ਜਾਂਦੀ ਹੈ ਤਾਂ ਸਾਡੇ ਬੱਚੇ ਵੀ ਆਉਣ ਵਾਲੀ ਪੀੜ੍ਹੀ ਵੀ ਅੱਗੇ ਵਧਣ ਦੇ ਲਈ ਅੰਗਰੇਜ਼ੀ ਭਾਸ਼ਾ ਨੂੰ ਅਪਣਾ ਰਹੇ ਆ ਬਾਹਰ ਜਾਣ ਦੇ ਲਈ ਵੀ ਇੰਗਲਿਸ਼ ਭਾਸ਼ਾ ਨੂੰ ਹੀ ਅਪਣਾ ਰਹੇ ਆ ਜਦੋਂ ਕਿ ਸਾਡੀ ਪੰਜਾਬੀ ਭਾਸ਼ਾ ਜਿਹੜੀ ਆ ਬਹੁਤ ਜਿਆਦਾ ਹਰਮਨ ਪਿਆਰੀ ਹੈ ਸਿਰਫ਼ ਸਾਡੀ ਨਹੀਂ ਸਾਡੇ ਤੋਂ ਬਾਹਰਲੇ ਦੇਸ਼ਾਂ ਦੀ ਵੀ ਹੁਣ ਤਾਂ ਫੋਰਨ ਕੰਟਰੀਆਂ ਵਾਲਿਆਂ ਨੇ ਵੀ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕੀਤਾ ਹੋਇਆ ਹੈ ਪਰ ਸਾਡੇ ਦੇਸ਼ ਦੇ ਵਿੱਚੋਂ ਸਾਡੀ ਹੀ ਪੰਜਾਬੀ ਭਾਸ਼ਾ ਨੂੰ ਖਤਮ ਕਰ ਦਿੱਤਾ ਜਾਣ ਲੱਗਾ ਹੈ ਇਹਨਾਂ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਦੇ ਮਗਰ ਲੱਗ ਕੇ ਹਿੰਦੀ ਅਤੇ ਭਾਸ਼ਾ ਬਹੁਤ ਜ਼ਿਆਦਾ ਸਾਡੇ ਦੇਸ਼ ਵਿੱਚ ਬੋਲੀ ਜਾਂਦੀ ਹੈ ਬਹੁਤ ਜ਼ਿਆਦਾ ਲਾਇਕ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਨੂੰ ਤਾਂ ਨਾ ਮਾਤਰ ਹੀ ਹੁਣ ਸਮਝਿਆ ਜਾਂਦਾ ਹੈ ਥੈੰਕਸ